ਮੈਂ ਕੱਪੜੇ ਆਪਣੇ ਵਾਸ਼ਿੰਗ ਮਸ਼ੀਨ ਵਿੱਚ ਧੌਂਦਾ ਹਾਂ ਇਸ ਵਿੱਚ ਕਈ ਵਾਰ ਮੌਸਮ ਮੀਂਹ ਵਾਲਾ ਬਣ ਜਾਂਦਾ ਹੈ ਤਾਂ ਮੈਨੂੰ ਕੱਪੜੇ ਕਈ ਵਾਰ ਅੰਦਰ ਰੱਖਣੇ ਪੈਂਦੇ ਹਨ ਜੇ ਧੁੱਪ ਤੇਜ਼ ਹੁੰਦੀ ਹੈ ਤਾਂ ਮੈਂ ਕੱਪੜੇ ਧੁੱਪ ਵਿੱਚ ਪਾ ਕੇ ਸੁਕਾ ਲੈਂਦਾ ਹਾਂ ਜਿਸ ਨਾਲ ਮੇਰਾ ਕੰਮ ਵੀ ਜਲਦੀ ਹੋ ਜਾਂਦਾ ਹੈ